ਖੇਤੀਬਾੜੀ ਪੰਜਾਬ ਵਿੱਚ ਖੇਤੀਬਾੜੀ ਲਈ ਕਈ ਨਵੀਆਂ ਤਕਨੀਕਾਂ ਆਈਆਂ ਹਨ ਅਤੇ ਕਈ ਪੁਰਾਣੀਆਂ ਤਕਨੀਕਾਂ ਵੀ ਪੁਰਾਣੇ ਸਮੇਂ ਵਿੱਚ ਖੇਤੀ ਨੂੰ ਹਲਟਾਂ ਨਾਲ਼ ਕੀਤਾ ਜਾਂਦਾ ਸੀ ਖੇਤੀਬਾੜੀ ਵਿੱਚ ਪਾਣੀ ਲਾਉਣ ਲਈ ਹਲਟਾਂ ਦਾ ਪ੍ਰਯੋਗ ਕੀਤਾ ਜਾਂਦਾ ਸੀ ਉਸ ਤੋਂ ਬਾਅਦ ਜਦੋਂ ਤੋਂ ਹਰੀ ਕ੍ਰਾਂਤੀ ਆਈ ਤਾਂ ਨਵੀਆਂ ਤਕਨੀਕਾਂ ਦਾ ਸਹਿਯੋਗ ਮਿਲ ਗਿਆ ਪੰਜਾਬ ਵਿੱਚ ਲੋਕਾਂ ਦੇ ਪੈਸੇ ਵੀ ਵੱਧ ਗਏ ਅਤੇ ਨਵੀਆਂ ਨਵੀਆਂ ਨਵੀਆਂ ਕਾਢਾਂ ਦਾ ਪ੍ਰਯੋਗ ਹੋਇਆ ਖੇਤੀਬਾੜੀ ਕਰਨ ਲਈ ਨਵੀਆਂ ਮਸ਼ੀਨਾਂ ਨਵੇਂ ਟਰੈਕਟਰਾਂ ਦਾ ਪ੍ਰਯੋਗ ਕੀਤਾ ਜਾ ਰਿਹਾ ਹੈ ਜਿਸ ਨਾਲ਼ ਪੰਜਾਬ ਦੇ ਕਿਸਾਨਾਂ ਨੂੰ ਮੁ ਮੁਆਵਜ਼ਾ ਵੀ ਮਿਲਿਆ ਇਸ ਕਰਕੇ ਨਵੀਂ ਖੇਤੀ ਵਿੱਚ ਪੰਜਾਬ ਦੇ ਉੱਚੇ ਪੱਧਰ 'ਤੇ ਉਹਨਾਂ ਦੇ ਖੇਤੀ